ਸਾਡੇ ਪੇਂਡੂ ਖੇਤਰ ਵਿੱਚ ਇੱਕ ਵਾਰ ਸੱਭਿਆਚਾਰਕ ਮੁਕਾਬਲੇ ਆਏ ਸਨ ਜਿਸ ਵਿੱਚ ਹੈਗੇ ਸੀ ਲੋਕ ਨਾਚ ਲੋਕ ਗੀਤ ਆਏ ਸਨ ਇਹਨਾਂ ਵਿੱਚੋਂ ਮੈਨੂੰ ਲੋਕ ਨਾਚ ਬਹੁਤ ਪਸੰਦ ਸੀ ਅਤੇ ਮੈਂ ਬਚਪਨ ਤੋਂ ਹੀ ਸੱਭਿਆਚਾਰਕ ਨਾਚ ਕਰਦੀ ਹਾਂ ਜਿਵੇਂ ਲੋਕ ਗੀਤਾਂ ਉੱਤੇ ਨੱਚਿਆ ਜਾਂਦਾ ਹੈ ਇਹ ਲੋਕ ਗੀਤ ਸਾਡੇ ਵਿਆਹ ਸਮਾਰੋਹ ਉੱਤੇ ਗਾਏ ਜਾਂਦੇ ਹਨ ਇਹਨਾਂ ਉੱਤੇ ਨੱਚਿਆ ਜਾਂਦਾ ਹੈ ਇਹ ਮੁਕਾਬਲਾ ਜਿਹੜੀ ਜਿਹੜਾ ਸੀ ਪਿਛਲੇ ਜੂਨ ਦੇ ਮਹੀਨੇ ਵਿੱਚ ਆਇਆ ਸੀ ਇਸ ਵਿੱਚ ਮੈਂ ਡਾਂਅਸ ਵਿੱਚ ਭਾਗ ਲਿਆ ਸੀ ਮੈਂ ਉਸ ਵਿੱਚ ਪਹਿਲੇ ਨੰਬਰ 'ਤੇ ਆਈ ਸੀ ਅਤੇ ਮੈਨੂੰ ਡਾਂਸ ਕਰਨਾ ਬਹੁਤ ਪਸੰਦ ਹੈ ਅਤੇ ਮੈਨੂੰ ਬਹੁਤ ਮਾਣ ਔਰ ਖੁਸ਼ੀ ਹੈ ਕਿ ਮੈਂ ਇਸ ਡਾਂਸ ਭਾਗ ਵਿੱਚ ਪਹਿਲੇ ਨੰਬਰ 'ਤੇ ਆਈ ਹਾਂ ਔਰ ਮੈਨੂੰ ਡਾਂਸ ਕਰਨਾ ਬਹੁਤ ਹੀ ਵਧੀਆ ਲੱਗਦਾ ਹੈ